ਸਤਿ ਸ਼੍ਰੀ ਅਕਾਲ ਜੀ ਗੁਪਤਾ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਸਰ ਮੈਂ ਹੁਣੇ ਨਾ ਸਵੀਗੀ ਤੋਂ ਔਡਰ ਕੀਤਾ ਸੀ ਅਤੇ ਗਲਤੀ ਦੇ ਨਾਲ ਮੇਰੇ ਕੋਲ ਗਲਤ ਪਤਾ ਦਿੱਤਾ ਗਿਆ ਆ ਅਤੇ ਮੈਂ ਆਪਣਾ ਪਤਾ ਬਦਲਵਾਉਣਾ ਚਾਹੁੰਦੀ ਹਾਂ ਹਾਂਜੀ ਹਾਂਜੀ ਸਰ ਜਸਲੀਨ ਕੌਰ ਦੇ ਨਾਮ 'ਤੇ ਔਡਰ ਹੈ ਔਡਰ ਆਈ ਡੀ ਔਡਰ ਆਈ ਡੀ ਸਰ ਮੇਰੀ ਸੱਤ ਅੱਠ ਪੰਜ ਛੇ ਅੱਠ ਨੌ ਸੱਤ ਅੱਠ ਹੈ ਹਾਂਜੀ ਸਰ ਸਰ ਦਾਲ ਰੋਟੀ ਅਤੇ ਸ਼ਾਹੀ ਪਨੀਰ ਸੀਗਾ ਮੈਂ ਗਲਤੀ ਦੇ ਨਾਲ ਪਹਿਲੇ ਆਪਣਾ ਘਰ ਪ੍ਰਤਾਪ ਬਾਜ਼ਾਰ ਵੱਲ ਰਹਿੰਦੀ ਹੁੰਦੀ ਸੀ ਅਤੇ ਗਲਤੀ ਦੇ ਨਾਲ ਮੇਰੇ ਕੋਲ ਓਹੀ ਓ ਪਤਾ ਦਿੱਤਾ ਗਿਆ ਆ ਅਤੇ ਹੁਣ ਮੈਂ ਆਪਣਾ ਘਰ ਬਦਲੀ ਕਰ ਲਿਆ ਆ ਅਤੇ ਹੁਣ ਮੈਂ ਦਸ਼ਮੇਸ਼ ਅ ਅਕੈਡਮੀ ਵੱਲ ਰਹਿੰਦੀ ਹਾਂ ਹਾਂਜੀ ਹਾਂਜੀ ਉੱਥੇ ਇੱਕ ਲਾਲ ਰੰਗ ਦੀ ਗੱਡੀ ਲੱਗੀ ਹੋਏਗੀ ਅਤੇ ਉਹਦੇ ਲਾਗੇ ਇੱਕ ਦਰੱਖਤ ਹੈ ਦਰੱਖਤ ਦਾ ਸਾਹਮਣਾ ਘਰ ਮੇਰਾ ਹੈ ਹਾਂਜੀ ਹਾਂਜੀ ਸਰ ਬਾਕੀ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਆਪਣੇ ਸਵੀਗੀ ਪ ਜਿਹੜਾ ਡਿਲੀਵਰ ਕਰਦਾ ਉਹਦਾ ਨੰਬਰ ਦੇ ਦਿਉ ਹਾਂਜੀ ਹਾਂਜੀ ਸਰ ਬਾਕੀ ਮੈਂ ਕੋਈ ਨਾ ਉਹਨੂੰ ਸਮਝਾ ਦਾਂਗੀ ਕਿਰਪਾ ਕਰਕੇ ਪਤਾ ਚੇਂਜ ਕਰ ਦਿਉ ਅਤੇ ਜਲਦੀ ਤੋਂ ਜਲਦੀ ਖਾਣਾ ਭੇਜ ਦਿਉ ਹਾਂਜੀ ਧੰਨਵਾਦ ਜੀ